ਪੰਜਾਬੀ ਭਾਸ਼ਾ ਦਾ ਇਤਿਹਾਸ ਇੱਕ ਸਮੇਂ ਦੀ ਯਾਤਰਾ ਪੰਜਾਬੀ ਭਾਸ਼ਾ ਇੱਕ ਅਮੀਰ ਇਤਿਹਾਸ ਵਾਲੀ ਭਾਸ਼ਾ ਹੈ ਜਿਸ ਨੇ ਸਦੀਆਂ ਦੌਰਾਨ ਕਈ ਤਬਦੀਲ ਤਬਦੀਲੀਆਂ ਅਤੇ ਵਿਕਾਸ ਦੇ ਪੜਾਅ ਦੇਖੇ ਹਨ ਇਹ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਇਸ ਦਾ ਮੂਲ ਸੰਸਕ੍ਰਿਤ ਭਾਸ਼ਾ ਨਾਲ ਜੁੜਿਆ ਹੋਇਆ ਹੈ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਆਰੀਆ ਲੋਕਾਂ ਦਾ ਆਗਮਨ ਲਗਭਗ ਪੰਦਰਾਂ ਸੌ ਈਸਾ ਪੂਰਬ ਵਿੱਚ ਆਰੀਆ ਲੋਕਾਂ ਦੇ ਭਾਰਤ ਆਉਣ ਨਾਲ ਇਸ ਖੇਤਰ ਵਿੱਚ ਇੱਕ ਨਵੀਂ ਭਾਸ਼ਾ ਦਾ ਜਨਮ ਹੋਇਆ ਇਸ ਭਾਸ਼ਾ ਦਾ ਸੰਪਰਕ ਸਥਾਨਕ ਭਾਸ਼ਾਵਾਂ ਨਾਲ ਹੋਇਆ ਅਤੇ ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਬੀਜ ਬੀਜਿਆ ਗਿਆ ਵੈਦਿਕ ਭਾਸ਼ਾ ਅਤੇ ਸੰਸਕ੍ਰਿਤ ਆਰੀਆ ਲੋਕਾਂ ਆਪਣੇ ਨਾਲ ਵੈਦਿਕ ਭਾਸ਼ਾ ਲਿਆਉਂਦੇ ਸਨ ਇਸ ਭਾਸ਼ਾ ਦਾ ਵਿਕਾਸ ਹੋ ਕੇ ਸੰਸਕ੍ਰਿਤ ਬਣੀ ਪੰਜਾਬੀ ਭਾਸ਼ਾ ਵੀ ਇਸੇ ਸੰਸਕ੍ਰਿਤ ਤੋਂ ਹੀ ਵਿਕਸਿਤ ਹੋਈ ਪ੍ਰਕਿਰਤੀ ਅਤੇ ਅਪਭ੍ਰਸ਼ ਸੰਸਕ੍ਰਿਤ ਦੇ ਆਮ ਲੋਕਾਂ ਦੁਆਰਾ ਵਰਤੇ ਜਾਣ ਨਾਲ ਪ੍ਰਕਿਰਤੀ ਅਤੇ ਅਪਭ੍ਰਸ਼ ਭਾਸ਼ਾਵਾਂ ਦਾ ਜਨਮ ਹੋਇਆ ਪੰਜਾਬੀ ਭਾਸ਼ਾ ਇਹਨਾਂ ਅਪਭ੍ਰਸ਼ਾਂ ਵਿੱਚੋਂ ਹੀ ਵਿਕਸਿਤ ਹੋਈ ਮੁਸਲਮਾਨੀ ਹਮਲੇ ਅਤੇ ਫਾਰਸੀ ਦਾ ਪ੍ਰਭਾਵ ਮੁਸਲਮਾਨੀ ਹਮਲਿਆਂ ਨਾਲ ਪੰਜਾਬੀ ਭਾਸ਼ਾ ਵਿੱਚ ਫਾਰਸੀ ਸ਼ਬਦਾਂ ਦਾ ਪ੍ਰਵੇਸ਼ ਹੋਇਆ ਇਸ ਨਾਲ ਭਾਸ਼ਾ ਦੀ ਸ਼ਬਦਾਵਲੀ ਵਿੱਚ ਕਾਫੀ ਵਾਧਾ ਹੋਇਆ ਸਿੱਖ ਧਰਮ ਦੇ ਗੁਰਮੁਖੀ ਲਿਪੀ ਸਿੱਖ ਧਰਮ ਦੇ ਉਤਾਰ ਨਾਲ ਪੰਜਾਬੀ ਭਾਸ਼ਾ ਨੂੰ ਇਕ ਨਵੀਂ ਮਿ ਪਛਾਣ ਮਿਲੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿੱਪੀ ਵਿੱਚ ਹੋਈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਇੱਕ ਮਜ਼ਬੂਤ ਅਧਾਰ ਮਿਲਿਆ ਸਮੇਂ ਦੇ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਲੋਕ ਸਾਹਿਤ ਪੰਜਾਬੀ ਲੋਕ ਸਾਹਿਤ ਜਿਵੇਂ ਕਿ ਗੀਤ ਬੋਲੀਆਂ ਲੋਕ ਕਹਾਣੀਆਂ ਆਦਿ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਇਆ ਸਾਹਿਤਕ ਰਚਨਾਵਾਂ ਵੱਡੀ ਗਿਣਤੀ ਵਿੱਚ ਪੰਜਾਬੀ ਕਵੀਆਂ ਅਤੇ ਲੇਖਕਾਂ ਨੇ ਪੰਜਾਬੀ ਭਾਸ਼ਾ ਵਿੱਚ ਅਮੀਰ ਸਾਹਿਤ ਸਿਰਜਿਆ ਭਾਸ਼ਾ ਦੀਆਂ ਬੋਲੀਆਂ ਪੰਜਾਬੀ ਭਾਸ਼ਾ ਦੀਆਂ ਕਈ ਬੋਲੀਆਂ ਜਿਵੇਂ ਕਿ ਮਾਝੀ ਮਲਵਈ ਦੁਆਬੀ ਆਦਿ ਦਾ ਵਿਕਾਸ ਹੋਇਆ ਆਧੁਨਿਕ ਪੰਜਾਬੀ ਵੀਹਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਨੇ ਆਧੁਨਿਕ ਰੂਪ ਧਾਰਨ ਕੀਤਾ ਅੱਜ ਕੱਲ੍ਹ ਪੰਜਾਬੀ ਭਾਸ਼ਾ ਨੂੰ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਬੋਲਿਆ ਜਾਂਦਾ ਹੈ